ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਅੱਜ ਜਿਵੇਂ ਸਾਨੂੰ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਹੋਰ ਰੂਪਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਦੇ ਉੱਤਰ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਦਾ ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਹੋਰ ਰੂਪਾਂ ਵਿੱਚ ਵਰਤੋਂ ਬਹੁਤ ਹੀ ਸੋਹਣੇ ਅਤੇ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਇਹ ਕਹਿੰਦੇ ਹਨ ਕਿ ਪੰਜਾਬੀ ਸੱਭਿਆਚਾਰ ਇਤਿਹਾਸ ਨੂੰ ਚੰਗੀ ਤਰ੍ਹਾਂ ਨਾਲ ਦੱਸਣ ਵਿੱਚ ਕਿਵੇਂ ਮਦਦ ਕਰਦਾ ਹੈ ਇਸ ਦੇ ਵਿੱਚ ਜੇ ਮੈਂ ਸਾਹਿਤ ਦੀ ਗੱਲ ਕਰਾਂ ਇਸ ਵਿੱਚ ਆਉਂਦਾ ਹੈ ਕਿ ਸਾਹਿਤ ਮਤਲਬ ਹੁੰਦਾ ਕਿ ਲਿਖਤੀ ਰੂਪ ਜਿਹੜਾ ਲਿਖਤੀ ਰੂਪ ਹੁੰਦਾ ਉਹਨੂੰ ਕਹਿੰਦੇ ਸਾਹਿਤ ਇਸ ਵਿੱਚ ਨਾਵਲ ਅਤੇ ਕਹਾਣੀਆਂ ਆਉਂਦੀਆਂ ਹਨ ਜਿਵੇਂ ਕਿ ਇਹ ਕੀ ਹੁੰਦਾ ਹੈ ਕਿ ਪੰਜਾਬੀ ਸਾਹਿਤ ਵਿੱਚ ਨਾਵਲ ਜੇ ਕਹਾਣੀਆਂ ਜਿਹੜੀਆਂ ਹੁੰਦੀਆਂ ਨਾ ਉਹ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਦਰਸਾਉਂਦੀਆਂ ਹਨ ਇਹ ਸਾਨੂੰ ਵੱਖ ਵੱਖ ਸਮਾਜਿਕ ਮੁੱਦਿਆਂ 'ਤੇ ਕਹਾਣੀਆਂ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ ਇਸ ਵਿੱਚ ਦੂਜਾ ਆਉਂਦਾ ਹੈ ਨਾਟਕ ਜਾਂ ਰੂਪਕਾਵਾਂ ਇਹ ਕੀ ਹੁੰਦੀਆਂ ਹਨ ਕਿ ਇਸ ਵਿੱਚ ਨਾ ਪੰਜਾਬੀ ਨਾਟਕ ਅਤੇ ਰੂਪਕਾਵਾਂ ਜਿਹੜੀਆਂ ਹੁੰਦੀਆਂ ਨਾ ਉਹ ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਨਿਭਾਉਂਦੀਆਂ ਹਨ ਦੂਜਾ ਆਉਂਦਾ ਸਾਡਾ ਕਵਿਤਾ ਕਵਿਤਾ ਵਿੱਚ ਕੀ ਆਉਂਦਾ ਹੈ ਜਿਵੇਂ ਸ਼ਾਇਰੀ ਜਾਂ ਗੀਤ ਜਾਂ ਗੁਰਬਾਣੀ ਆ ਜਾਂਦੀ ਹੈ ਸ਼ਾਇਰੀ ਵਿੱਚ ਕੀ ਹੁੰਦਾ ਹੈ ਕਿ ਪੰਜਾਬੀ ਸ਼ਾਇਰੀ ਵਿੱਚ ਪਿਆਰ ਦੁੱਖ ਖੁਸ਼ੀ ਜਾਂ ਵੱਖ ਵੱਖ ਭਾਵਨਾਵਾਂ ਨੂੰ ਸੁੰਦਰ ਸ਼ਬਦਾਂ ਵਿੱਚ ਪੇਸ਼ ਕੀਤਾ ਜਾਂਦਾ ਇਹ ਜਿਹੜੀਆਂ ਹੁੰਦੀਆਂ ਨਾ ਇਹ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਹੁੰਦੀਆਂ ਹਨ ਅਤੇ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਮਦਦ ਬਹੁਤ ਕਰਦੀਆਂ ਹਨ ਜੇ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਕਵਿਤਾ ਦਾ ਮਹੱਤਵਪੂਰਨ ਰੂਪ ਹੈ ਇਹ ਕਿ ਸਿੱਖ ਧਰਮ ਦੇ ਦੇ ਸਿਧਾਂਤਾਂ ਨੂੰ ਪੇਸ਼ ਕਰਦਾ ਹੈ ਇਹ ਜੀ ਕਵਿਤਾ ਹੁੰਦੀਆਂ ਨੇ ਇਹਦੇ ਵਿੱਚ ਲਿਖੇ ਸ਼ਬਦ ਜਿਹੜੇ ਹੁੰਦੇ ਆ ਉਹ ਸਿੱਖ ਧਰਮ ਦੇ ਸਿਧਾਂਤਾਂ ਜਾਂ ਫਿਰ ਜੀਵਨ ਦੇ ਭਾਵਾਂ ਨੂੰ ਦਰਸਾਉਂਦੇ ਹਨ ਤੀਜਾ ਆ ਜਾਂਦਾ ਸਾਡਾ ਕਲਰ ਕਲਾਤਮਕ ਪ੍ਰਗਟਾਵੇ ਦੇ ਹੋਰ ਰੂਪ ਕਿਹੜੇ ਕਿਹੜੇ ਹਨ ਇਹਦੇ ਵਿੱਚ ਮੈਂ ਦੱਸਾਂ ਤੁਹਾਨੂੰ ਤਾਂ ਇਸ ਵਿੱਚ ਚਿੱਤਰਕਲਾ ਆ ਜਾਂਦੀ ਹੈ ਜਾਂ ਮੂਰਤੀ ਕਲਾ ਆ ਜਾਂਦੀ ਹੈ ਜਾਂ ਫਿਰ ਸੰਗੀਤ ਜਾਂ ਨਾਚ ਸੰਗ ਚਿੱਤਰਕਲਾ ਜਾਂ ਮੂਰਤੀ ਕਲਾ ਵਾਲੇ ਜੇ ਦੱਸਾਂ ਤਾਂ ਇਸ ਵਿੱਚ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਚਿੱਤਰਾਂ ਜਾਂ ਮੂਰਤੀਆਂ ਵਿੱਚ ਵਰਤਿਆ ਜਾਂਦਾ ਹੈ ਇਸ ਵਿੱਚ ਜੇ ਆਪਾਂ ਇੱਕ ਇਗਜੈਂਪਲ ਲਈਏ ਤਾਂ ਪੇਂਟਿੰਗ ਹੋ ਜਾਂਦੀ ਆ ਪੇਂਟਿੰਗ ਵਿੱਚ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਮੂਰਤੀਆਂ 'ਤੇ ਲਿਖਿਆ ਜਾਂਦਾ ਦੂਜਾ ਜੇ ਸੰਗੀਤ ਇਹਦੇ ਨਾਚ ਦੀ ਗੱਲ ਕਰੀਏ ਇਸ ਵਿੱਚ ਹੁੰਦਾ ਹੈ ਕਿ ਪੰਜਾਬੀ ਸੰਗੀਤ ਅਤੇ ਨਾਚ ਦੇ ਰੂਪ ਵਿੱਚ ਭਾਸ਼ਾ ਨੂੰ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਕੀ ਹੁੰਦਾ ਹੈ ਕਿ ਲੋਕ ਗੀਤ ਆ ਜਾਂਦੇ ਹਨ ਭੰਗੜਾ ਆ ਜਾਂਦਾ ਗਿੱਧਾ ਆ ਜਾਂਦਾ ਹੈ ਹੋਰ ਵੀ ਆਦਿ ਅਤੇ ਅੰਤ ਵਿੱਚ ਕਹਿਣਾ ਚਾਹੁੰਦਾ ਕਿ ਇਹ ਸਾਰੇ ਰੂਪ ਨਾ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਜਾਂ ਫਿਰ ਉਹਦੇ ਵੱਖ ਵੱਖ ਸੰਸਕਾਰਾਂ ਨੂੰ ਵਧਾਉਣ ਵਾਲੇ ਹਨ ਇਹ ਸ ਸਾਡੇ ਪੰਜਾਬੀ ਵਿਰਸੇ ਜਾਂ ਸੱਭਿਆਚਾਰ ਨੂੰ ਨਾ ਅਮਰ ਬਣਾਉਂਦੇ ਹਨ ਧੰਨਵਾਦ